ਸਤਿ ਸ਼੍ਰੀ ਅਕਾਲ ਜੀ ਅਸਲ ਵਿੱਚ ਮੈਨੂੰ ਇੱਕ ਨਵਾਂ ਘਰ ਖਰੀਦਣ ਲਈ ਲੋਨ ਲੈਣ ਦੀ ਜ਼ਰੂਰਤ ਹੈ ਇਸ ਲਈ ਮੈਂ ਤੁਹਾਡੇ ਪਾਸ ਆਇਆ ਹਾਂ ਮੇਰੇ ਕੋਲ ਮੇਰੇ ਬਿਜਲੀ ਅਤੇ ਪਾਣੀ ਦੇ ਬਿੱਲ ਦੇ ਸਾਰੇ ਸਬੂਤ ਵੀ ਹਨ ਤੁਸੀਂ ਉਹਨਾਂ ਸਭ ਨੂੰ ਦੇਖ ਸਕਦੇ ਹੋ ਇਸ ਤੋਂ ਇਲਾਵਾ ਮੇਰੀ ਨੌਕਰੀ ਮੇਰੀ ਨੌਕਰੀ ਅਤੇ ਮੇਰੀ ਤਨਖਾਹ ਇੰਨੀ ਕੁ ਹੈ ਕਿ ਮੈਂ ਕਰਜ਼ੇ ਨੂੰ ਕਰਜ਼ੇ ਨੂੰ ਪੂਰੇ ਸਮੇਂ 'ਤੇ ਵਾਪਸ ਕਰ ਸਕਦਾ ਹਾਂ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਮੈਨੂੰ ਕਰਜ਼ਾ ਦੇਣ ਦੇਣ ਬਾਰੇ ਸੋਚਿਆ ਜਾਵੇ ਅਤੇ ਇਹ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ ਜਾਵੇ ਧੰਨਵਾਦ